ਹੈਲੋ ਨਮਸ਼ਕਾਰ ਜੀ ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਫੋਟੋਆਂ ਦੇ ਪ੍ਰਾਈਜ ਹੈਗੇ ਜੀ ਜਿਵੇਂ ਛੋਟੀ ਛੇ ਅੱਠ ਦੀ ਫੋਟੋ ਹੈਗੀ ਉਹ ਸੱਠ ਰੁਪਈਏ ਹੈਗੀ ਜੀ ਉਹ ਤੋਂ ਵੱਡੀ ਆ ਗਈ ਦਸ ਬਾਰਾਂ ਦੀ ਉਹ ਸੌ ਰੁਪਈਏ ਦੇ ਕਰੀਬ ਹੈਗੀ ਜੀ ਹਾਂਜੀ ਉਸ ਤੋਂ ਵੱਡੀ ਆ ਜਾਂਦੀ ਹੈਗੀ ਬਾਰਾਂ ਚੌਦਾਂ

ਆਮ ਤਾਂ ਚੱਲਦੀ ਹੈ ਛੇ ਅੱਠ ਹੀ ਜ਼ਿਆਦਾ ਤਾਂ ਹਾਂਜੀ ਛੇ ਅੱਠ ਦਾ ਸੱਠ ਰੁਪਈਏ ਜੀ ਹਾਂਜੀ ਨਹੀਂ ਫਿਰ ਦਸ ਬਾਰਾਂ ਲੈ ਲਓ ਹਾਂ ਹਾਂ ਹਾਂ ਆ ਹਾਂ ਉਹਦੇ 'ਚ ਸਾਰੇ ਆ ਜਏ ਹਾਂਜੀ

ਹਾਂਜੀ ਹਾਂਜੀ ਉਹ ਵਧੀਆ ਪੇਪਰ ਹੁੰਦਾ ਹਾਂਜੀ ਹਾਂਜੀ ਨਹੀਂ ਵਧੀਆ ਹੈ ਵਧੀਆ

ਠੀਕ ਹੈ ਠੀਕ ਹੈ ਜੀ ਉਹ ਜੀ ਸਾਰਾ ਹੋ ਜਾਵੇਗਾ ਠੀਕ ਹੈ ਜੀ ਹਾਂਜੀ ਹਾਂ ਅਡਵਾਂਸ ਹੁੰਦਾ ਹੈ ਜੀ ਉਹ ਤਾਂ ਪੰਜ ਕ ਹਜ਼ਾਰ ਜੀ ਹਾਂਜੀ ਹਾਂ ਐਲਬਮ ਤਿਆਰ ਹੋਣ ਤੋਂ ਬਾਅਦ ਐਲਬਮ ਵੇਖ ਕੇ ਉਸ ਤੋਂ ਬਾਅਦ ਠੀਕ ਹੈ ਜੀ ਓਕੇ